ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਮਹੀਨੇ ਪਹਿਲਾਂ ਤੁਹਾਡੇ ਤੋਂ ਫ਼ੋਨ ਮੰਗਵਾਇਆ ਸੀ ਇਸ ਦਾ ਹੀ ਪੈਕੇਜਿੰਗ ਬਹੁਤ ਹੀ ਬੇਕਾਰ ਹੈ ਅਤੇ ਇਹ ਫ਼ੋਨ ਵੀ ਟੁੱਟਿਆ ਹੋਇਆ ਹੈ ਅਤੇ ਇਸ ਦੇ ਸਾਰੇ ਟੂਲਜ਼ ਵੀ ਬਿਖਰੇ ਹੋਏ ਸਨ ਅਤੇ ਵਿੱਚੋਂ ਟੁੱਟੇ ਹੋਏ ਸਨ ਅਤੇ ਇਹ ਇਸਦੀ ਡਿਸਪਲੇਅ ਵੀ ਖ਼ਰਾਬ ਹੈ ਬਹੁਤ ਰੁਕ ਰੁਕ ਕੇ ਚੱਲਦੀ ਹੈ ਅਤੇ ਤੁਸੀਂ ਦੱਸਿਆ ਸੀਗਾ ਇਹ ਦੋ ਦਿਨ ਕੱਢਦੀ ਹੈ ਬੈਟਰੀ ਪਰ ਇਹ ਤਾਂ ਇੱਕ ਦਿਨ ਮਸਾਂ ਕੱਢਦੀ ਹੈ ਇਸ ਦਾ ਬੈਕ ਕੈਮਰਾ ਬਹੁਤ ਹੀ ਬੇਕਾਰ ਹੈ ਅਤੇ ਇਸਦੇ ਫਰੰਟ ਕੈਮਰੇ ਦੀ ਫੋਟੋ ਵੀ ਬਹੁਤ ਬੇਕਾਰ ਆਉਂਦੀ ਹੈ ਅਤੇ ਇਹ ਇਸਦੀ ਫਾਸਟ ਚ ਚਾਰਜਿੰਗ ਨਹੀਂ ਹੁੰਦੀ ਅਤੇ ਇਹ ਦੋ ਘੰਟੇ ਲਗਾ ਦਿੰਦਾ ਹੈ ਚਾਰਜ ਹੋਣ ਨੂੰ ਇਸਦੀ ਸਾਊਂਡ ਕੁਆਲਿਟੀ ਵੀ ਬਹੁਤ ਬੇਕਾਰ ਹੈ ਅਤੇ ਅਸੀਂ ਤੁਹਾਡੇ ਕੋਲੋਂ ਕੋਈ ਵੀ ਅੱਗੋਂ ਫ਼ੋਨ ਨਹੀਂ ਮੰਗਵਾਵਾਂਗੇ ਅਤੇ ਮੇਰਾ ਫ਼ੋਨ ਦੁਅ ਚੇਂਜ ਕਰਕੇ ਦੇਵੋ ਨਹੀਂ ਤਾਂ ਮੇਰੇ ਪੈਸੇ ਵਾਪਸ ਕਰ ਦਿਉ ਧੰਨਵਾਦ